ਦੇਖੋ ਜੀ ਰਹੀ ਗੱਲ ਸੱਭਿਆਚਾਰਕ ਵਿੱਚ ਪੰਜਾਬੀ ਭਾਸ਼ਾ ਦੀ ਪਹਿਚਾਣ ਦੀ ਭੂਮਿਕਾ ਜਿਹੜੀ ਆ ਸਭ ਤੋਂ ਮੇਨ ਸਾਡੀ ਪੰਜਾਬੀ ਭਾਸ਼ਾ ਹੀ ਆ ਸਾਡੀ ਪੰਜਾਬ ਵਾਸਤੇ ਸਾਡੇ ਜੋ ਸੱਭਿਆਚਾਰ ਨੂੰ ਦਰਸਾਉਂਦੀ ਆ ਪੰਜਾਬੀ ਭਾਸ਼ਾ ਬਿਨਾ ਸਾਡਾ ਸੱਭਿਆਚਾਰਕ ਨਹੀਂ ਚੱਲ ਸਕਦਾ ਅਤੇ ਸਾਨੂੰ ਪੰਜਾਬੀ ਭਾਸ਼ਾ ਆਉਂਦੀ ਹੋਵੇਗੀ ਲਿਖਣੀ ਪੜ੍ਹਨੀ ਬੋਲ ਦੀ ਫਿ ਬੋਲਣੀ ਫਿਰ ਹੀ ਆਪਾਂ ਆਪਣੇ ਸੱਭਿਆਚਾਰ ਨੂੰ ਬਾਰੇ ਜਾਣ ਸਕਾਂਗੇ ਕਿ ਸੱਭਿਆਚਾਰ ਕੀ ਆ ਸਾਡਾ ਕਲਚਰ ਕੀ ਹੈ ਜੋ ਵੀ ਹੈਗਾ ਸਾਨੂੰ ਸਭ ਕੁਛ ਸਾਡੀ ਭਾਸ਼ਾ ਮੇਨ ਜ਼ਰੂਰੀ ਹੈ ਜੀ ਠੀਕ ਪੰਜਾਬੀ ਭਾਸ਼ਾ ਦੀ ਬਹੁਤ ਵੱਡੀ ਭੂਮਿਕਾ ਵਾ ਸਾਡੇ ਸੱਭਿਆਚਾਰਕ ਵਿੱਚ ਜੇ ਸੱਭਿਆ ਜੇ ਸਾਡੀ ਪੰਜਾਬੀ ਭਾਸ਼ਾ ਨਹੀਂ ਤਾਂ ਸੱਭਿਆਚਾਰਕ ਫਿਰ ਜੇ ਸਾਨੂੰ ਭਾਸ਼ਾ ਨਹੀਂ ਆਵੇਗੀ ਪੰਜਾਬੀ ਅਸੀਂ ਸੱਭਿਆਚਾਰਕ ਬਾਰੇ ਕਿੱਦਾਂ ਜਾਣ ਸਕਾਂਗੇ ਸਾਨੂੰ ਕਿੱਦਾਂ ਪਤਾ ਲੱਗੇਗਾ ਜਿੱਦਾਂ ਕਿ ਹਰ ਰਾਜ ਦੀ ਵੱਖ ਵੱਖ ਭਾਸ਼ਾ ਹੁੰਦੀ ਆ ਮਹਾ ਮਰਾਠਿਆਂ ਵਾਸ ਮਹਾਰਾਸ਼ਟਰ ਵਾਲਿਆਂ ਵਾਸਤੇ ਮਰਾਠੀ ਭਾਸ਼ਾ ਠੀਕ ਹੈ ਰਾਜਸਥਾਨ ਵਾਸਤੇ ਆ ਉਹਨਾਂ ਦੀ ਵੱਖਰੀ ਬੋਲੀ ਉਸੇ ਤਰ੍ਹਾਂ ਸਾਡੀ ਹਰਿਆਣਵੀਆਂ ਵਾਸਤੇ ਹਰਿਆਣਵੀ ਉਸ ਤਰ੍ਹਾਂ ਸਾਡੀ ਪੰਜਾਬੀ ਭਾਸ਼ਾ ਸਾਨੂੰ ਬਹੁਤ ਜ਼ਰੂਰੀ ਆ ਸੱਭਿਆਚਾਰਕ ਪਹਿਚਾਣ ਕਰਨ ਵਾਸਤੇ ਸਾਨੂੰ ਪੰਜਾਬੀ ਭਾਸ਼ਾ ਆਉਣੀ ਬਹੁਤ ਜ਼ਰੂਰੀ ਆ ਆਉਣੀ ਸਮਝਣੀ ਬਹੁਤ ਜ਼ਰੂਰੀ ਆ ਇਹਦਾ ਬਹੁਤ ਵੱਡਾ ਇਹਦੀ ਬਹੁਤ ਵੱਡੀ ਭੂਮਿਕਾ ਵਾ ਸਾਡੇ ਰਾਜ ਦੇ ਸੱਭਿਆਚਾਰਕ ਵਿੱਚ ਧੰਨਵਾਦ ਜੀ